ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਆਪਣੀ ਡਰਾਇੰਗਾਂ ਲਈ ਪ੍ਰੇਰਨਾ ਵੱਖ ਵੱਖ ਜਗਾਵਾਂ ਤੋਂ ਪ੍ਰਾਪਤ ਕਰ ਸਕਦੇ ਹਾਂ ਸਭ ਤੋਂ ਵੱਡੀ ਸਾਨੂੰ ਪ੍ਰੇਰਨਾ ਆਪਣੇ ਆਸ ਪਾਸ ਆਪਣਾ ਰਹਿਣਾ ਸਹਿਣਾ ਖਾਣਾ ਪੀਣਾ ਅਤੇ ਪਹਾੜਾਂ 'ਤੇ ਜਾ ਕੇ ਨੇਚਰ ਤੋਂ ਪ੍ਰਾਪਤ ਹੁੰਦੀ ਹੈ ਨੇਚਰ ਸਾਡੇ ਲਈ ਬਹੁਤ ਹੀ ਪ੍ਰੇਰਨਾ ਵੱਡਾ ਪ੍ਰੇਰਨਾ ਸਰੋਤ ਹੈ ਜਿਹਦੇ ਅੰਦਰ ਸਾਨੂੰ ਪਹਾੜ ਝੀਲ ਝਰਨੇ ਪੰਛੀ ਅਤੇ ਆਪਣੇ ਖਾਣ ਪੀਣ ਦੇ ਅਤੇ ਰਹਿਣ ਕਰਨ ਦੇ 'ਚ ਬਹੁਤ ਹੀ ਹੈਲਪਫੁਲ ਹੁੰਦੀ ਹੈ ਅੱਜ ਦੇ ਦੌਰ 'ਚ ਡਰਾਇੰਗ ਇੱਕ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਸਰੋਤ ਹੈ ਜਿਹਦੇ ਕਰਕੇ ਅਸੀਂ ਆਪਣੇ ਜਿਹੜੇ ਵੀ ਦਿਮਾਗੀ ਤੌਰ 'ਤੇ ਵੀ ਬਹੁਤ ਹੀ ਪ੍ਰਫੁੱਲ ਰਹਿੰਦੇ ਹਾਂ ਕਿਉਂਕਿ ਇਹ ਸਾਨੂੰ ਬੜਾ ਹੀ ਬਿਜ਼ੀ ਕਰ ਦਿੰਦੀ ਹੈ ਅਤੇ ਅਸੀਂ ਆਪਣੇ ਦਿਮਾਗ ਨੂੰ ਲਾ ਲਾ ਕੇ ਉਸ 'ਚੋਂ ਚੰਗੀ ਤਰ੍ਹਾਂ ਅੱਛੀ ਡਰਾਇੰਗਾਂ ਬਣਾਉਂਦੇ ਹਾਂ ਇਹਦੇ ਲਈ ਸਾਨੂੰ ਸਭ ਤੋਂ ਪਹਿਲੇ ਕਲਪਨਾ ਤੋਂ ਡਰਾਇੰਗ ਵਿੱਚ ਅੰਤਰ ਦੀ ਵਿਆਖਿਆ ਆਪਾਂ ਕਰ ਸਕਦੇ ਹਾਂ ਸਭ ਤੋਂ ਪਹਿਲੇ ਅਸੀਂ ਕਲਪਨਾ ਤੋਂ ਮਨੋ ਵਿਆਖਿਆ ਹੈ ਕਿ ਉਸ ਨੂੰ ਪ੍ਰਸਤੁਤ ਕਰਨ ਦੇ ਤਰੀਕੇ ਆਉਣੇ ਸਾਰੀ ਕਲਪਨਾ ਨੂੰ ਸਹੀ ਕਰ ਦਿੰਦੇ ਨੇ ਜਦੋਂ ਅਸੀਂ ਕਲਪਨਾ ਵਧੀਆ ਬਣਾਉਂਦੇ ਹਾਂ ਤਾਂ ਅਸੀਂ ਸਾਨੂੰ ਕੰਮ ਕਰਨਾ ਔਰ ਵੀ ਆਸਾਨ ਹੋ ਜਾਂਦਾ ਹੈ ਇਹਦੇ ਲਈ ਜਦੋਂ ਕਲਪਨਾ ਦੇ ਬਾਅਦ ਹੀ ਅਸੀਂ ਉਹਨੂੰ ਇੱਕ ਡਰਾਇੰਗ ਦੀ ਵਰਤੋਂ 'ਚ ਲਿਆ ਸਕਦੇ ਹਾਂ ਜੇ ਕਲਪਨਾ ਸਹੀ ਨਹੀਂ ਹੈ ਤਾਂ ਨਹੀਂ ਕਰ ਪਾ ਸਕਦੇ ਆਪਾਂ